ਤੁਸੀਂ ਟੂ ਤੁਸੀਂ ਟੂਰਿਸਟ ਗਾਈਡ ਹੋ ਅਤੇ ਮੈਂ ਮੈਂ ਨਾ ਅਨੰਦਪੁਰ ਸਾਹਿਬ ਜਾਣਾ ਸੀ ਹੋਲੇ ਮਹੱਲੇ 'ਤੇ ਅਤੇ ਮੈਂ ਉਸ ਰਿਗਾਰਡਿੰਗ ਇਨਫੋਰਮੇਸ਼ਨ ਲੈਣੀ ਸੀ ਵੀ ਕਿਸ ਕਿੱਦਾਂ ਦਾ ਉਹ ਹੈ ਅਤੇ ਮਤਲਬ ਉੱਥੇ ਕੀ ਕੁਛ ਹੁੰਦਾ ਵਾ ਅਤੇ ਉੱਥੇ ਕਿੰਨੇ ਕਿੰਨੇ ਕੁ ਦਿਨ ਲੱਗ ਸਕਦੇ ਆ ਅਸੀਂ ਘੁੰਮਣਾ ਵਾ ਹੋਰ ਵੀ

ਗੁਰਦੁਆਰੇ ਸਾਹਿਬ ਸਾਨੂੰ ਘਰ ਮਿਲ ਸਕਦੇ ਹੈ ਅਤੇ ਲੰਗਰ ਦੇ ਕੀ ਪ੍ਰਬੰਧਤਾ ਹੈ ਉੱਥੇ ਤੁਹਾਡੇ ਟੂਰਿਸਟ ਗਾਈਡ ਦਾ ਖਰਚਾ ਕਿੰਨਾ ਕੁ ਆ ਸਕਦਾ ਮੈਨੂੰ ਤੁਸੀਂ ਆਪਣੀ ਥੋੜ੍ਹੀ ਪੇਮੈਂਟ ਦਾ ਆਈਡੀਆ ਦੇ ਦਿਓ ਸਾਨੂੰ ਫੁੱਲ ਟਾਈਮ ਗਾਈਡ ਚਾਹੀਦੀ ਹੈ ਕਿਉਂਕਿ ਅਸੀਂ ਬਹੁਤ ਦੂਰ ਤੋਂ ਆਈ ਜਾਂਦੇ ਹਾਂ ਅਤੇ ਸਾਨੂੰ ਇਸ ਇਹਦੀ ਕੋਈ ਵੀ ਇਨਫੋਰਮੇਸ਼ਨ ਹੈ ਨੀਗੀ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਅਨੰਦਪੁਰ ਸਾਹਿਬ ਬਹੁਤ ਵਧੀਆ ਮੇਲਾ ਲੱਗਦਾ ਹੋਲੇ ਮਹੱਲੇ ਦਾ ਅਤੇ ਅਸੀਂ ਸੋਚਿਆ ਵੀ ਅਸੀਂ ਆ ਕੇ ਇੱਕ ਵਾਰ ਜ਼ਰੂਰ ਦਰਸ਼ਨ ਕਰਕੇ ਜਾਵਾਂਗੇ ਅਤੇ ਸਾਨੂੰ ਇਸ ਲਈ ਟੂਰਿਸਟ ਗਾਈਡ ਦੀ ਲੋੜ ਪੈ ਰਹੀ ਹੈ ਠੀਕ ਹੈ ਅਤੇ ਉੱਥੇ ਹਰੇਕ ਟਾਈਪ ਦੀ ਫੈਸਿਲਟੀ ਹੈਗੀਆਂ ਨੇ ਓਕੇ ਅਤੇ ਠੀਕ ਹੈ ਫੇਰ ਅਸੀਂ ਤੁਹਾਨੂੰ ਕਾਲ ਕਰ ਦਾਂਗੇ ਤੁਹਾਡੀ ਏਜੰਸੀ 'ਚ ਓਕੇ ਬਾਏ